ਹੈਲੋ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਹੈਲ ਹਾਂਜੀ ਮੈਂ ਗੀਤਾ ਬੋਲਦੀ ਪਈ ਹਾਂ ਤੁਹਾਡੀ ਪੇਸ਼ੈਂਟ ਮੇਰੇ ਨਾ ਲੱਕ 'ਚ ਦਰਦ ਦੀ ਮੈਂ ਦਵਾਈ ਲੈਂਦੀ ਤੁਹਾਡੇ ਕੋਲੋਂ ਅਤੇ ਉਹ ਕੱਲ੍ਹ ਦੀ ਮੇਰੇ ਲੱਕ 'ਚ ਦਰਦ ਬਹੁਤ ਜ਼ਿਆਦੇ ਹੁੰਦੀ ਪਈ ਏ ਅਤੇ ਮੈਨੂੰ ਕੋਈ ਚੰਗੀ ਜਿਹੀ ਮੈਡੀਸਨ ਦੱਸੋ ਜਿਹਦੇ ਨਾਲ਼ ਮੈਨੂੰ ਥੋੜ੍ਹਾ ਰਾਹਤ ਮਿਲੇ ਕਿਉਂਕਿ ਪਹਿਲੀ ਦਵਾਈ ਨਾਲ਼ ਥੋੜ੍ਹਾ ਆਰਾਮ ਨਹੀਂ ਲੱਗਾ

ਹਾਂਜੀ

ਹਾਂ ਹਾਂ ਠੀਕ ਹੈ ਹਾਂਜੀ ਅਤੇ ਮੈਨੂੰ ਦਵਾਈ ਸੈਂਡ ਕਰ ਦਿਓ ਫਿਰ ਮੈਂ ਤੁਹਾਡੇ ਕੋਲੋਂ ਚੈੱਕਅੱਪ ਬਾਅਦ 'ਚ ਕਰਵਾ ਲਾਂਗੀ ਆ ਕੇ ਠੀਕ ਹੈ ਡੋਕਟਰ ਸਾਹਿਬ ਥੈਂਕ ਯੂ